ਹਾਂਜੀ ਏ ਆਈ ਆਰਟੀਫੈਸ਼ਲ ਜਿਹੜੀ ਇੰਟੈਲੀਜੈਂਸ ਉਹਦੇ ਬਾਰੇ ਸਾਨੂੰ ਪਤਾ ਹੈ ਜਾਣਦੇ ਹਾਂ ਇਹਦੇ ਬਾਰੇ ਏ ਆਈ ਜਿਹੜੀ ਹੈਗੀ ਆ ਬੜੀ ਐਡਵਾਂਸ ਟੈਕਨੀਕ ਹੈ ਤਾਂ ਇਹਦੇ ਕੁਛ ਫ਼ਾਇਦੇ ਵੀ ਨੇ ਅਤੇ ਆਪਣੇ ਨੁਕਸਾਨ ਵੀ ਨੇ ਇਹਦਾ ਫਾਇਦਾ ਤਾਂ ਇਹੀ ਆ ਵੀ ਆਪਾਂ ਨੂੰ ਜਿਹੜੀ ਹੈਗੀ ਆ ਜਿਹੜੀ ਟਾਈਮ ਦੀ ਬੱਚਤ ਹੁੰਦੀ ਆ ਟਾਈਮ ਸੇਵਿੰਗ ਹੁੰਦੀ ਆ ਕੋਈ ਚੀਜ਼ ਆਪਾਂ ਫਾਇੰਡ ਆਊਟ ਕਰਨੀ ਆ ਉਹਦੇ ਜਿੰਨੇ ਵੀ ਹੈਗੇ ਆ ਮੋਸਟ ਇੰਪੋਰਟੈਂਟ ਚੀਜ਼ਾਂ ਉਹ ਆਪਾਂ ਨੂੰ ਸਾਹਮਣੇ ਸਿੰਥੇਥਾਈਜ਼ ਕਰਕੇ ਆਪਣੇ ਸਾਹਮਣੇ ਲਿਆ ਦਿੰਦੀ ਹੈ ਤਾਂ ਉਸ ਪੁਆਇੰਟ ਆੱਫ ਵਿਊ 'ਤੇ ਜਿਹੜੀ ਹੈਗੀ ਆ ਆਪਣੀ ਏ ਆਈ ਕਾਫ਼ੀ ਜ਼ਿਆਦਾ ਹੈਲਪਫੁੱਲ ਆ ਕਾਫ਼ੀ ਜ਼ਿਆਦਾ ਮਦਦਗਾਰ ਹੈ ਬਟ ਨਾਲ਼ ਨਾਲ਼ ਇਹ ਆਪਣੀ ਨੁਕਸਾਨ ਵੀ ਹੈਗਾ ਵੱਡਾ ਨੁਕਸਾਨ ਤਾਂ ਇਹੀ ਆ ਵੀ ਆਪਾਂ ਜਿਹੜੀ ਹਿਊਮਨ ਦੀ ਕ੍ਰੀਏਟਿਵਿਟੀ ਆ ਰਚਨਾਤਮਕ ਦਾ ਜਿਹੜਾ ਪੱਖ ਹੈ ਇਹ ਹਿਊਮਨ ਦਾ ਉਹ ਗਵਾਤਾ ਗਵਾਇਆ ਜਾ ਰਿਹਾ ਹੈਗਾ ਹਿਊਮਨ ਜਿਹੜੇ ਹੈਗੇ ਨੇ ਆਪ ਨਾ ਸੋਚਦੇ ਹੋਏ ਐਨੇ ਕੁ ਆਲਸੀ ਹੋ ਰਹੇ ਨੇ ਵੀ ਉਹ ਕੁਛ ਵੀ ਆਪ ਕਰਨ ਦੀ ਥਾਂ 'ਤੇ ਸੋਚਣ ਦੀ ਥਾਂ 'ਤੇ ਉਹਦੇ ਰਿਗਾਰਡਿੰਗ ਜੋ ਕੁਛ ਸਭ ਉਹਨਾਂ ਨੇ ਪੜ੍ਹਨਾ ਹੁੰਦਾ ਕੁਛ ਲੱਭਣਾ ਹੁੰਦਾ ਹੈਗਾ ਏ ਆਈ ਤੋਂ ਕਹਿੰਦੇ ਆ ਕਿ ਉਹ ਚੀਜ਼ ਕ੍ਰੀਏਟ ਕਰ ਜੇ ਕੋਈ ਉਹਨਾਂ ਨੇ ਕਵਿਤਾ ਲਿਖਣੀ ਆ ਉਹ ਕਵਿਤਾ ਵੀ ਉਹ ਤੋਂ ਲਿਖਾਉਣ ਲੱਗ ਗਏ ਨੇ ਕੋਈ ਕੋਡਿੰਗ ਕਰਨੀ ਆ ਪ੍ਰੋਗਰਾਮ ਦੀ ਕੋਡਿੰਗ ਉਹ ਤੋਂ ਕਰਵਾਉਣ ਲੱਗ ਗਏ ਨੇ ਕ ਈਵਨ ਕਿ ਕੁਝ ਤਾਂ ਆਪਣੇ ਥੀਸਸ ਵਗੈਰਾ ਵੀ ਉਹ ਤੋਂ ਲਿਖਵਾਉਣ ਲੱਗ ਗਏ ਨੇ ਤਾਂ ਇਸ ਕਰਕੇ ਜਿਹੜੀ ਜੋ ਇੱਕ ਓਰੀਜਨਲ ਵਰਕ ਹੋਣਾ ਸੀ ਕੁਛ ਕ੍ਰੀਏਟਿਵਿਟੀ ਹੋਣੀ ਸੀ ਉਸ ਕ੍ਰੀਏਟਿਵਿਟੀ ਉੱਪਰ ਕੁਛ ਨਾ ਕੁਛ ਜਿਹੜਾ ਹੈ ਇਫੈਕਟ ਪੈ ਰਿਹਾ ਕਾਫ਼ੀ ਜ਼ਿਆਦਾ ਇਫੈਕਟ ਉਹਦੇ ਉੱਪਰ ਪੈ ਰਿਹਾ ਹੈਗਾ